ਸਤਿ ਸ਼੍ਰੀ ਅਕਾਲ ਜੀ ਸੈਮਸੰਗ ਕੰਪਨੀ ਤੋਂ ਗੱਲ ਕਰ ਰਹੇ ਹੋ ਮੈਂ ਕੁਛ ਦਿਨ ਪਹਿਲਾਂ ਤੁਹਾਡੀ ਕੰਪਨੀ ਦਾ ਫ਼ੋਨ ਖ਼ਰੀਦਿਆ ਸੀ ਜੋ ਕਿ ਸਹੀ ਤਰੀਕੇ ਨਾਲ਼ ਨਹੀਂ ਚੱਲ ਰਿਹਾ ਉਹਦੇ ਸਪੀਕਰ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਉਹ ਅਤੇ ਉਸਦੀ ਸਕਰੀਨ ਵੀ ਸਹੀ ਤਰੀਕੇ ਨਾਲ਼ ਕੰਮ ਨਹੀਂ ਕਰ ਰਹੀ ਅਤੇ ਮੈਂ ਚਾਹੁੰਦੀ ਹਾਂ ਕਿ ਉਸ ਨੂੰ ਫ਼ੋਨ ਨੂੰ ਜਾਂ ਤਾਂ ਬਦਲਿਆ ਜਾਵੇ ਜਾਂ ਉਸਦੀ ਰਿਪੇਅਰ ਕੀਤੀ ਜਾਵੇ ਕਿਉਂਕਿ ਮੇਰੇ ਕੋਲ ਬਿੱਲ ਡੱਬਾ ਔਰ ਫ਼ੋਨ ਗਰੰਟੀ ਦੇ ਵਿੱਚ ਹੈ ਮੇਰੇ ਕੋਲ ਸਭ ਕੁਛ ਪਿਆ ਹੈ